ਸਤਿ ਸ਼੍ਰੀ ਅਕਾਲ ਭਾਅ ਜੀ ਤੁਸੀਂ ਸੰਨੀ ਬੈਕਰੀ ਤੋਂ ਗੱਲ ਕਰ ਰਹੇ ਹੋ ਮੈਨੂੰ ਤੁਹਾਡਾ ਨੰਬਰ ਮੇਰੇ ਦੋਸਤ ਨੇ ਦੱਸਿਆ ਸੀ ਮੈਂ ਪਟਿਆਲੇ ਵਿੱਚ ਨਵਾਂ ਨਵਾਂ ਸ਼ਿਫਟ ਹੋਇਆ ਹਾਂ ਅਤੇ ਕੁਝ ਮੇਰੇ ਨਾਲ ਦੇ ਦੋਸਤ ਵੀ ਨਵੇਂ ਨਵੇਂ ਸ਼ਿਫਟ ਹੋਏ ਹਨ ਸਾਨੂੰ ਇਹ ਜਗ੍ਹਾ ਦਾ ਕੋਈ ਜ਼ਿਆਦਾ ਪਤਾ ਨਹੀਂ ਹੈ ਅਤੇ ਮੇਰੇ ਦੋਸਤਾਂ ਨੇ ਹੀ ਮੈਨੂੰ ਤੁਹਾਡੇ ਬਾਰੇ ਦੱਸਿਆ ਹੈ ਸੰਨੀ ਬੇਕਰੀ ਦਾ ਤੁਹਾਡਾ ਕਾਫੀ ਨਾਮ ਹੈ ਪਟਿਆਲੇ ਵਿੱਚ ਅਤੇ ਮੈਂ ਤਾਂ ਹੀ ਤੁਹਾਡੇ ਕੋਲ ਪਹੁੰਚਿਆ ਹਾਂ ਆਉਣ ਵਾਲੀ ਸਤਾਈ ਮਾਰਚ ਦੋ ਹਜ਼ਾਰ ਚੌਵੀ ਨੂੰ ਮੇਰੇ ਦੋਸਤ ਦਾ ਜਨਮ ਦਿਨ ਹੈ ਮੈਂ ਇਸ ਜਨਮ ਦਿਨ ਵਿੱਚ ਖਾਣ ਪਿਲਾਉਣ ਦੀ ਸਾਰੀ ਜ਼ਿੰਮੇਵਾਰੀ ਮੈਂ ਆਪਣੇ ਮੋਢਿਆਂ ਉੱਤੇ ਲਈ ਹੈ ਅਤੇ ਮੈਂ ਪਤਾ ਕੀਤਾ ਹੈ ਤਾਂ ਪਤਾ ਕਰਨ 'ਤੇ ਪਤਾ ਲੱਗਿਆ ਹੈ ਕਿ ਤੁਸੀਂ ਸਭ ਤੋਂ ਵਧੀਆ ਪਟਿਆਲੇ ਵਿੱਚ ਖਾਣ ਪੀਣ ਦਾ ਕੰਮ ਕਰਦੇ ਹੋ ਇਸ ਲਈ ਭਾਅ ਜੀ ਮੈਂ ਤੁਹਾਨੂੰ ਕਹਿ ਰਿਹਾ ਹਾਂ ਕਿ ਤਿੰਨੇ ਟਾਈਮ ਦੀ ਰੋਟੀ ਮੋਰਨਿੰਗ ਬਰੇਕਫਾਸਟ ਦੁਪਹਿਰ ਦਾ ਲੰਚ ਅਤੇ ਰਾਤ ਦਾ ਡਿਨਰ ਅਤੇ ਗਿਆਰਾਂ ਕੁ ਵਜੇ ਅਤੇ ਪੰਜ ਕੁ ਵਜੇ ਦੀ ਚਾਹ ਤੁਹਾਡੇ ਵੱਲੋਂ ਕੀਤੀ ਜਾਏ ਮੈਂ ਚਾਹੁੰਦਾ ਹਾਂ ਕਿ ਤੁਸੀਂ ਸਵੇਰੇ ਸਾਜਰੇ ਅੱਠ ਕੁ ਵੱਜਦੇ ਨੂੰ ਸਭ ਕੁਝ ਖਾਣ ਪੀਣ ਤਿਆਰ ਕਰ ਦਿਓ ਅਤੇ ਕਾਰੀਗਰ ਵੀ ਆਪਣੇ ਹੀ ਭੇਜ ਦੇਣਾ ਜਿਨ੍ਹਾਂ ਨੇ ਕੰਮ ਕਰਨਾ ਹੈ ਉਮੀਦ ਹੈ ਤੁਸੀਂ ਸਾਰਾ ਕੁਛ ਮੈਨੂੰ ਸਹੀ ਰੇਟ 'ਤੇ ਲਾਓਗੇ ਅਤੇ ਮੈਨੂੰ ਤੁਹਾਡੇ ਵੱਲੋਂ ਵਧੀਆ ਕੰਮ ਮਿਲ ਜਾਏਗਾ ਸਵੇਰੇ ਮਾਰਨਿੰਗ ਵਿੱਚ ਇੱਕ ਛੋਲੇ ਭਟੂਰੇ ਦੀ ਆਈਟਮ ਨਾਲ ਪੂਰੀਆਂ ਨਾਲ ਇੱਕ ਸਿੰਪਲ ਜੋ ਕਿ ਗੈਸ ਘੱਟ ਕਰੇ ਰੋਟੀਆਂ ਅਤੇ ਸਬਜ਼ੀ ਨਾਲ ਦਹੀਂ ਜਿਸ ਵਿੱਚ ਕਿ ਰਾਇਤਾ ਤਿਆਰ ਕੀਤਾ ਜਾਵੇ ਅਤੇ ਨਾਲ ਦੁੱਧ ਅਤੇ ਚਾਹ ਰੱਖੀ ਜਾਏ ਇਸ ਦੇ ਨਾਲ ਨਾਲ ਗਿਆਰਾਂ ਕੁ ਵੱਜਦੇ ਨੂੰ ਸਾਰੇ ਆਏ ਮਹਿਮਾਨਾਂ ਲਈ ਚਾਹ ਤਿਆਰ ਕੀਤੀ ਜਾਏ ਚਾਹ ਤੋਂ ਬਾਅਦ ਦੁਪਹਿਰ ਦੀ ਰੋਟੀ ਵਿੱਚ ਸਾਰਾ ਕੁਛ ਦਾਲ ਮੱਖਣੀ ਸ਼ਾਹੀ ਪਨੀਰ ਕੜਾਹੀ ਪਨੀਰ

ਮੱਛੀ ਦੇ ਨਾਲ ਨਾਲ ਚਿਕਨ ਰੱਖਿਆ ਜਾਏ ਜਿੱਦਾਂ ਕਿ ਚਿਕਨ ਕੜਾਹੀ ਚਿਕਨ ਹੋ ਗਿਆ ਅਤੇ ਹੋਰ ਚਿਕਨ ਰੱਖੇ ਜਾਣ ਜਿਵੇਂ ਕਿ ਬਟਰ ਚਿਕਨ ਹੋ ਗਿਆ ਇਹ ਸਾਰੀਆਂ ਆਈਟਮਾਂ ਰੱਖੀਆਂ ਜਾਣ ਅਤੇ ਨਾਲ ਬਟਰ ਨਾਨ ਰੋਟੀਆਂ ਅਤੇ ਦੋ ਚਾਰ ਖਾਣ ਹੋਰ ਆਈਟਮਾਂ ਰੱਖੀਆ ਜਾਣ ਸ਼ਾਮ ਨੂੰ ਯਾਨੀ ਕਿ ਦੁਪ ਸ਼ਾਮ ਨੂੰ ਪੰਜ ਕੁ ਵੱਜਦੇ ਨੂੰ ਫਿਰ ਚਾਹ ਕੀਤੀ ਜਾਈ ਅਤੇ ਰਾਤ ਦਾ ਡਿਨਰ ਜਿਸ ਵਿੱਚ ਕਿ ਸਿੰਪਲ ਰੋਟੀ ਹੋ ਗਈ ਤੁਸੀਂ ਆਪਣੇ ਹਿਸਾਬ ਦੇ ਨਾਲ ਇਨਕਲੂਡ ਕਰਕੇ ਮੈਨੂੰ ਮੈਨਿਊ ਦੱਸ ਦੇਣਾ ਜੋ ਤੁਸੀਂ ਡਿਨਰ ਵਿੱਚ ਰੋ ਪਰੋ ਪਰੋਸਦੇ ਹੋ ਇਸ ਦੇ ਨਾਲ ਨਾਲ ਮੈਨੂੰ ਸਾਰਾ ਪ੍ਰੋਗਰਾਮ ਖ਼ਤਮ ਕਰ ਕੇ ਪੂਰੇ ਦਿਨ ਦਾ ਤੁਹਾਡਾ ਖਰਚਾ ਦੱਸਿਓ ਤਾਂ ਜੋ ਮੈਂ ਆਪਣਾ ਰੇਟ ਫਿਕਸ ਬਿਠਾ ਸਕਾਂ ਤੁਹਾਡੇ ਨਾਲ ਗੱਲ ਕਰਾਂ ਅਤੇ ਕੁਛ ਛੋਟ ਵੀ ਦਿਓ ਮੈਨੂੰ ਇਸ ਚੀਜ਼ ਉੱਤੇ ਕਿਉਂਕਿ ਪੂਰੇ ਦਿਨ ਦਾ ਖਰਚਾ ਹੈ ਅਤੇ ਤੁਹਾਡੇ ਹੋਏ ਇਹਦੇ ਵਿੱਚ ਫਾਇਦਾ ਹੋ ਸਕਦਾ ਹੈ ਮੇਰਾ ਵੀ ਫਾਇਦਾ ਹੋ ਸਕਦਾ ਹੈ ਇਸ ਲਈ ਕਿਰਪਾ ਕਰਕੇ ਮੈਨੂੰ ਇਸ 'ਤੇ ਵਧੀਆ ਛੋਟ ਦੇਣਾ ਧੰਨਵਾਦ